ਭੰਗੜਾ ਪੰਜਾਬੀ ਸੱਭਿਆਚਾਰਕ ਦੀ ਇੱਕ ਪ੍ਰਮੁੱਖ ਨੀਤੀ ਹੈ ਜੋ ਖ਼ਾਸ ਤੌਰ 'ਤੇ ਖੁਸ਼ੀ ਅਤੇ ਤਿਉਹਾਰਾਂ ਦੇ ਮੌਕੇ 'ਤੇ ਕੀਤਾ ਜਾਂਦਾ ਹੈ ਭੰਗੜੇ ਦੇ ਕੁਛ ਆਮ ਸਟੈਪ ਹਨ ਹੱਥਾਂ ਦੀ ਮੋੜੀ ਅਤੇ ਚਾਲ ਹੱਥਾਂ ਨੂੰ ਅਕਸਰ ਉੱਥੇ ਓਤੇ ਹਿਲਾਇਆ ਜਾਂਦਾ ਹੈ ਅਤੇ ਫਿਰ ਪੈਰਾਂ ਦੀ ਲੈਗ ਨਾਲ ਇਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਪੈਰਾਂ ਦੀ ਚਾਲ ਭੰਗੜਾ ਭੰਗੜੇ ਵਿੱਚ ਪੈਰਾਂ ਦੇ ਵਿੱਚ ਜਲਦੀ ਚਾਲ ਹੁੰਦੀ ਹੈ ਜਿਸ ਵਿੱਚ ਪੈਰਾਂ ਨੂੰ ਬੜੀ ਤੇਜ਼ੀ ਨਾਲ ਉੱਠਦੇ ਅਤੇ ਡੋਨ ਕਰਦੇ ਹਨ ਸਿਰ ਨੂੰ ਹਿਲਾਉਣਾ ਭੰਗੜਾ ਦੌਰਾਨ ਇਸ ਸਿਰ ਨੂੰ ਹਿਲਾਉਣਾ ਭੰਗੜੇ ਦੇ ਇੱਕ ਵਿਸ਼ੇਸ਼ ਖ਼ਾਸੀਅਤ ਹੈ ਜੋ ਲਗਾਤਾਰ ਹੁੰਦੀ ਰਹਿੰਦੀ ਹੈ ਹੱਥਾਂ ਨਾਲ ਜੁੰਜਲ ਕਈ ਵਾਰ ਭੰਗੜੇ ਵਿੱਚ ਜੋੜਿਆ ਦੀ ਜੁੰਜਲ ਜਾਂ ਸੰਗੀਤ ਨਾਲ ਤਾਲ ਮਿਲਾਉਣ ਦੀ ਵੀ ਹੁੰਦਾ ਹੈ ਭੰਗੜਾ ਪੰਜਾਬੀ ਸੱਭਿਆਚਾਰਕ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਕਿਉਂਕਿ ਇਹ ਖੁਸ਼ੀ ਇਹ ਖੁਸ਼ੀ ਭਾਵਨਾ ਅਤੇ ਜਸ਼ਨ ਦਾ ਪ੍ਰਤੀਕ ਹੈ ਇਹ ਨਾ ਸਿਰਫ਼ ਇੱਕ ਨੀਤੀ ਹੈ ਬਲਕਿ ਇੱਕ ਰਿਵਾਇਤੀ ਤਿਉਹਾਰ ਜਾਂ ਸਮਾਰੋਹ ਵਿੱਚ ਸਾਂਝੀ ਖੁਸ਼ੀ ਅਤੇ ਭਾਈਚਾਰੇ ਨੂੰ ਪ੍ਰਗਾ ਪ੍ਰਗਟ ਕਰਦਾ ਹੈ